ਹਾਂਜੀ ਮੈਂ ਪੰਜਾਬ ਦੇ ਵਿੱਚ ਰਹਿੰਦੀ ਹਾਂ ਅਤੇ ਪੰਜਾਬ ਵਿੱਚ ਹੀ ਨੌਕਰੀ ਕਰਦੀ ਹਾਂ ਮੇਰਾ ਰੋਟੀਨ ਦਾ ਰੋਜ਼ਾਨਾ ਦਾ ਇਹ ਕਰਮ ਹੈ ਵੀ ਮੈਂ ਬਾਕੀ ਜਿਹੜੇ ਅ ਸੂਬੇ ਨੇ ਉਹਨਾਂ ਦੇ ਲੋਕਾਂ ਦੇ ਨਾਲ਼ ਮਿਲਦੀ ਰਹਿੰਦੀ ਹਾਂ ਅਤੇ ਹਰ ਰੋਜ਼ ਹੀ ਉਹਨਾਂ ਦੀਆਂ ਮੁਸ਼ਕਿਲਾਂ ਵੀ ਸੁਣਦੇ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ ਅਤੇ ਉਹਨਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕਰੀ ਦੀ ਹੈ ਅਤੇ ਉਹਨਾਂ ਦੀਆਂ ਕੋਸ਼ਿਸ਼ ਕਰੀ ਦੀ ਹੈ ਵੀ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਵੀ ਕੀਤਾ ਜਾ ਸਕੇ ਬਹੁਤ ਵਧੀਆ ਲੱਗਦਾ ਬਾਹਰਲੇ ਲੋਕਾਂ ਨਾਲ ਵੀ ਗੱਲਬਾਤ ਕਰ ਕੇ ਠੀਕ ਹੈ ਇਹ ਇਨਸਾਨੀਅਤ ਤਾਂ ਹਰੇਕ ਜਗ੍ਹਾ ਇਸ ਕਰਕੇ ਸਾਨੂੰ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਹੈ ਆਪਣੇ ਠੀਕ ਹੈ ਆਪਣੇ ਸੂਬੇ ਨੂੰ ਪਿਆਰ ਕਰੋ ਆਪਣੀ ਮਾਤ ਬੋਲੀ ਨੂੰ ਪਿਆਰ ਕਰੋ ਮਾਤ ਭਾਸ਼ਾ ਨੂੰ ਪਿਆਰ ਕਰਨਾ ਇਹ ਸਾਡਾ ਪਹਿਲਾ ਕਰਮ ਹੈ ਪਰ ਦੂਸਰਿਆਂ ਦੀ ਭਾਸ਼ਾ ਦਾ ਸਤਿਕਾਰ ਕਰਨਾ ਇਹ ਵੀ ਸਾਡਾ ਕਰਮ ਹੈ ਇਸ ਕਰਕੇ ਜੇ ਦੂਸਰੀ ਭਾਸ਼ਾ ਦੇ ਲੋਕ ਸਾਡੇ ਨਾਲ ਮਿਲਦੇ ਗਿਲਦੇ ਨੇ ਅਤੇ ਉਹਨਾਂ ਦਾ ਸਤਿਕਾਰ ਕਰਨਾ ਇਹ ਸਾਡੀ ਜਿਹੜੀ ਹੈ ਮੌਲਿਕ ਕਰਤੱਵ ਬਣ ਜਾਂਦਾ ਔਰ ਮੈਨੂੰ ਬਹੁਤ ਵਧੀਆ ਲੱਗਦਾ ਦੂਜੇ ਸੂਬਿਆਂ ਦੇ ਲੋਕਾਂ ਦੇ ਨਾਲ਼ ਗੱਲਾਂ ਕਰ ਕੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ